ਹੈਲੋ ਹਾਂਜੀ ਹਾਂਜੀ ਮੈਂ ਟੂਰਿਸਟ ਗਾਈਡ ਬੋਲ ਰਿਹਾਂ ਬਿਲਕੁਲ ਬਿਲਕੁਲ ਉਹ ਪੰਜਾਬ ਦੇ ਵਿੱਚ ਬੜੇ ਸ਼ਾਸ਼ਕ ਰਹੇ ਆ ਇਤਿਹਾਸਿਕ ਉਹਨਾਂ ਦਾ ਰੋਲ ਪਲੇਅ ਰਿਹਾ ਵਾ ਬੜੇ ਬਹਾਦਰ ਸੀਗੇ ਉਹ ਬੜੀਆਂ ਲੜਾਈਆਂ ਲੜੀਆਂ ਉਹਨਾਂ ਨੇ ਆਪਣੇ ਰਾਜ ਦੀ ਸੁਰੱਕਸ਼ਾ ਵਾਸਤੇ ਬੜੇ ਲੜਾਈਆਂ ਲੜੀਆਂ ਉਹਨਾਂ ਨੇ ਅਤੇ ਪੰਜਾਬ ਦੀ ਤਾਕਤ ਨੂੰ ਬੜਾ ਵਧਾਇਆ ਉਹਨਾਂ ਨੇ ਅੰਗਰੇਜ਼ਾਂ ਦੇ ਖਿਲਾਫ਼ ਈਵਨ ਜਿਹੜਾ ਕਿ ਸੋਮਨਾਥ ਦੇ ਮੰਦਰ ਤੋਂ ਸੋਨਾ ਲੁੱਟ ਕੇ ਲੈ ਗਏ ਸੀ ਅੰਗਰੇਜ਼ ਉਹਨਾਂ ਨੇ ਬੜੀ ਯਤਨਾਂ ਦੇ ਨਾਲ਼ ਉਹ ਵਾਪਸ ਲਿਆਉਂਦਾ ਪਰ ਇੱਥੇ ਆਪਣੇ ਹਰਿਮੰਦਰ ਸਾਹਿਬ ਜਿਹੜਾ ਬਣਿਆ ਹੋਇਆ ਬੜਾ ਮਸ਼ਹੂਰ ਹੈ ਇੱਥੇ ਟੈਂਪਲ ਉੱਥੇ ਦਰਵਾਜ਼ਾ ਹਲੇ ਉਹ ਸੋਨੇ ਦਾ ਲੱਗਾ ਹੋਇਆ ਜਿਹੜਾ ਸੋਨਾ ਵਾਪਸ ਲੈ ਕੇ ਆਏ ਸੀਗੇ ਅਤੇ ਜੇ ਤੁਸੀਂ ਆਏ ਹੋ ਅਤੇ ਜ਼ਰੂਰ ਵਿਜ਼ਿਟ ਕਰੋ ਉੱਥੇ ਦੇਖ ਕੇ ਜਾਓ ਦਰਸ਼ਨ ਕਰੋ ਹਾਂ ਅਤੇ ਦੂਸਰਾ ਐ ਵੈ ਕਿ ਜਿਹੜਾ ਵੈ ਇੱਥੇ ਕੰਪਨੀ ਬਾਗ਼ ਆ ਉਹਨਾਂ ਦਾ ਇੱਕ ਪੁਤਲਾ ਵੀ ਲੱਗਾ ਹੋਇਆ ਘੌੜੇ 'ਤੇ ਹਾਂਜੀ ਉਹ ਉਹ ਵੀ ਬੜਾ ਦੇਖਣ ਦੇ ਲਾਇਕ ਆ ਵੈਲਕਮ ਵੈਲਕਮ